ਮੈਂ ਸਵੇਰੇ ਚਾਰ ਵਜੇ ਉੱਠ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਦੌੜਨ ਲਈ ਜਾਂਦੀ ਹਾਂ ਮੈਂ ਸਵੇਰੇ ਚਾਰ ਵਜੇ ਤੋਂ ਲੈ ਕੇ ਛੇ ਵਜੇ ਤੱਕ ਦੌੜਦੀ ਹਾਂ ਮੈਂ ਰੋਜ਼ ਪੰਜ ਕਿਲੋਮੀਟਰ ਜਾਣ ਅਤੇ ਪੰਜ ਕਿਲੋਮੀਟਰ ਵਾਪਸ ਆਉਣ ਦਾ ਸਮਾਂ ਤੈਅ ਕਰਦੀ ਹਾਂ ਤਾਂ ਜੋ ਮੈਂ ਕੋਈ ਜੋਬ ਕਰ ਸਕਾਂ ਇਸ ਲਈ ਮੈਨੂੰ ਪੁਲਿਸ ਦੀ ਜੋਬ ਮਿਲ ਜਾਵੇ